ਸਾਡੇ ਇੱਕ ਆਪਣੀ ਸਕਾਡ ਆ ਅਤੇ ਉਹ ਸਕਾਡ ਦੇ ਵਿੱਚ ਅਸੀਂ ਚਾਰ ਜਾਣੇ ਹੁੰਦੇ ਹਾਂ ਅਤੇ ਉਹਨਾਂ ਚਾਰਾਂ ਮਤਲਬ ਉਹ ਸਾਰੇ ਬਹੁਤ ਚੰਗਾ ਖੇਲਦੇ ਹਨ ਅਤੇ ਇੱਕ ਦਾ ਨਾਮ ਅਨੁਭਵ ਹੈ ਇੱਕ ਦਾ ਨਾਮ ਅਨੂਜ ਏ ਇੱਕ ਦਾ ਨਾਮ ਆਦਿਤਆ ਅਤੇ ਇੱਕ ਮੈਂ ਆ ਜੀ ਸਾਡੀ ਚਾਰ ਦੀ ਸਕੋਡ ਜਦ ਵੀ ਅਸੀਂ ਖੇਲਦੇ ਹੁੰਦੇ ਤਾਂ ਸਾਡਾ ਹਮੇਸ਼ਾਂ ਹਮੇਸ਼ਾਂ ਬੂਈਆ ਹੁੰਦਾ ਹੀ ਹੁੰਦਾ ਅਤੇ ਫਿਰ ਉਸ ਤੋਂ ਬਾਅਦ ਇੱਕ ਵਾਰ ਦੀ ਗੱਲ ਹੈ ਜੀ ਇੱਕ ਯੂਟਿਊਬ 'ਤੇ ਲਾਈਵ ਲਾਈਵ ਚੱਲਦਾ ਸੀਗਾ ਜੀ ਲਾਈਵ ਸ਼ੋਅ ਅਤੇ ਉਹਦੇ ਵਿੱਚ ਕਸਟਮ ਬਣਿਆ ਵਾ ਤਾ ਜੀ ਅਤੇ ਗਿਆਰ੍ਹਾਂ ਸੌ ਰੁਪਈਆ ਪ੍ਰਾਈਜ ਸੀਗਾ ਬੂਈਆ ਕਰਨ ਦਾ ਜੀ ਅਤੇ ਫਿਰ ਉਹਦੇ ਵਿੱਚ ਅਸੀਂ ਆਪਣੀ ਟੀਮ ਵੀ ਲੈ ਕੇ ਗਏ ਤੀ ਅਤੇ ਫਿਰ ਜਦ ਉਹਦੇ ਵਿੱਚ ਸਾਡੀ ਐਂਟਰੀ ਹੋਈ ਤਾਂ ਫਿਰ ਅਸੀਂ ਥੋੜ੍ਹੇ ਟਾਈਮ ਵਧੀਆ ਖੇਲਿਆ ਅਤੇ ਫਿਰ ਉਸ ਤੋਂ ਬਾਅਦ ਸਾਡਾ ਇੱਕ ਬੰਦਾ ਮਰ ਗਿਆ ਤਾ ਜੀ ਅਤੇ ਜਿਸ ਕਾਰਨ ਸਾਨੂੰ ਫਿਰ ਸਾਵਧਾਨੀ ਨਾਲ ਖੇਲਣਾ ਪਿਆ ਲੁਕ ਲੁਕ ਕੇ ਖੇਲਣਾ ਪਿਆ ਅਤੇ ਜਦ ਅਸੀਂ ਮੈਚ ਜਿੱਤੇ ਅਤੇ ਫਿਰ ਉਸ ਤੋਂ ਬਾਅਦ ਸਾਨੂੰ ਮਤਲਬ ਸਾਡਾ ਨਾਮ ਵੀ ਬੋਲਿਆ ਗਿਆ ਲਾਈਫ ਸਟਰੀਮ 'ਤੇ ਅਤੇ ਫਿਰ ਉਸ ਤੋਂ ਬਾਅਦ ਸਾਨੂੰ ਮਤਲਬ ਜਦ ਪ੍ਰਾਈਜ ਮਿਲਿਆ ਗਿਆਰ੍ਹਾਂ ਸੌ ਰੁਪਈਆ ਅਤੇ ਸਾਨੂੰ ਗੇਮ ਦੇ ਥਰੂ ਮਤਲਬ ਹੋਰ ਵਧੀਆ ਵਧੀਆ ਚੀਜ਼ਾਂ ਦਿੱਤੀ ਗਈ ਯੂਟਿਊਬਰ ਦੇ ਵੱਲੋਂ ਅਤੇ ਫਿਰ ਉਸ ਤੋਂ ਬਾਅਦ ਜਦ ਅਸੀਂ ਮਤਲਬ ਜਿੱਤੇ ਤਾਂ ਸਾਡਾ ਨਾਂ ਵੀ ਬੋਲਿਆ ਗਿਆ ਅਤੇ ਫਿਰ ਸਾਨੂੰ ਜਦ ਗਿਆਰ੍ਹਾਂ ਸੌ ਰੁਪਏ ਮਿਲੇ ਤਾਂ ਅਸੀ ਆਪਣੇ ਚਾਰਾਂ ਜਾਣਿਆਂ ਨੇ ਮਤਲਬ ਮਿਲ ਕੇ ਰਲ ਮਿਲ ਕੇ ਆਪਾਂ ਖਾ ਲਏ ਅਤੇ ਫਿਰ ਉਸ ਤੋਂ ਬਾਅਦ ਮਤਲਬ ਇੱਦਾਂ ਜਿਹਾ ਕਿ ਮਤਲਬ ਸਾਡੀ ਟੀਮ ਮਤਲਬ ਬਹੁਤ ਤਗੜੀ ਸੀਗੀ ਅਤੇ ਮਤਲਬ ਇੱਦਾਂ ਦੀਆਂ ਕਿ ਮਤਲਬ ਅਸੀਂ ਮਤਲਬ ਵਧੀਆ ਹੀ ਖੇਲੇ ਮਤਲਬ ਮਤਲਬ ਜਿੱਦਾਂ ਕੀ ਹੈ ਅਸੀਂ ਪਹਿਲਾਂ ਲਗਾਤਾਰ ਮਤਲਬ ਬੰਦੇ ਮਾਰ ਰਹੇ ਸੀਗੇ ਪਰ ਉਸ ਤੋਂ ਬਾਅਦ ਸਾਡਾ ਜ ਜਦ ਉਹ ਇੱਕ ਬੰਦਾ ਮਰਿਆ ਫਿਰ ਉਸ ਤੋਂ ਬਾਅਦ ਅਸੀਂ ਆਰਾਮ ਨਾਲ ਖੇਲਣ ਲੱਗ ਗਏ ਰਸ਼ ਕਰਕੇ ਨਹੀਂ ਖੇਲੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਜਦੋਂ ਜਦ ਵੀ ਅਸੀਂ ਖੇਲੇ ਤਾਂ ਫਿਰ ਮਤਲਬ ਸਾਵਧਾਨੀ ਨਾਲ ਖੇਲੇ ਫਿਰ ਜਦ ਅਸੀਂ ਮੈਚ ਜਿੱਤੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਅਤੇ ਅਸੀਂ ਰਲ ਮਿਲ ਕੇ ਮਤਲਬ ਜਦ ਵੀ ਅਸੀਂ ਖੇਲਣਾ ਹੁੰਦਾ ਸੀ ਚਾਰ ਜਣੇ ਹੀ ਖੇਲਦੇ ਕਿਉਂਕਿ ਇਹ ਚਾਰ ਸਾਡੀ ਇਹਨਾਂ ਚਾਰਾਂ ਨਾਲ ਸਾਡੀ ਸਕਾਡ ਦੀ ਪਹਿਚਾਣ ਆ ਅਤੇ ਮੈਂ ਆਹੀ ਕਹਿਣਾ ਚਾਹੂੰਗਾ ਕਿ ਮਤਲਬ ਅਸ ਅਸੀਂ ਚਾਰ ਜਾਣੇ ਮਤਲਬ ਸਾਰੇ ਅਤੇ ਬਹੁਤ ਜ਼ਿਆਦਾ ਮਤਲਬ ਲਾਭਦਾਇਕ ਮਤਲਬ ਸਾਰਿਆਂ ਮਤਲਬ ਸਾਰਿਆਂ ਦੀ ਮਤਲਬ ਟੀਮ ਸਾਡੇ ਤੋਂ ਵੀ ਜ਼ਿਆਦਾ ਵਧੀਆ ਸੀਗੀ ਪਰ ਅਸੀਂ ਆਪਣੀ ਟੀਮ ਨੂੰ ਬਿਹਤਰ ਬਣਾਉਣ ਵਾਸਤੇ ਅਸੀਂ ਚੰਗਾ ਖੇਲੇ ਅਤੇ ਅਸੀਂ ਬੂਈਆ ਕੀਤਾ